ਅੱਜ ਕੱਲ੍ਹ ਤਕਨੀਕੀ ਯੁੱਗ ਹੋਣ ਕਰਕੇ ਨਵੀਆਂ ਨਵੀਆਂ ਕਾਢਾਂ ਟਾਵਰ ਫਾਈਵ ਜੀ ਦੀ ਰੇਂਜ ਨੇ ਬਹੁਤ ਹੀ ਮਨੁੱਖੀ ਜ਼ਿੰਦਗੀ 'ਤੇ ਪੰਛੀਆਂ 'ਤੇ ਵਾਤਾਵਰਨ 'ਤੇ ਪ੍ਰਭਾਵਿਤ ਕੀਤਾ ਏ ਜਿਸ ਕਾਰਨ ਬਹੁਤ ਹੀ ਪੰਛੀਆਂ ਨੂੰ ਨੁਕਸਾਨ ਪਹੁੰਚਿਆ ਏ ਅਤੇ ਦੇਖਣ ਵਾਲੇ ਜ਼ਿਆਦਾਤਰ ਪੰਛੀ ਅੱਜ ਕੱਲ੍ਹ ਪਿੰਡਾਂ ਵਿੱਚ ਹੀ ਪਾਏ ਜਾਂਦੇ ਹਨ ਜਿਵੇਂ ਕਿ ਗਟਾਰ ਕੋਇਲ ਬੰਬੀਹਾ ਕਾਂ ਘੁੱਗੀ ਅਤੇ ਇੱਕ ਹੋਰ ਹੀ ਬਹੁਤ ਪੰਛੀ ਜਿਵੇਂ ਕਿ ਗੈਡ ਖੰਭ ਕਈ ਬੱਚਿਆਂ ਨੇ ਤਾਂ ਇਹਨਾਂ ਦੇ ਨਾਂ ਵੀ ਨਹੀਂ ਸੁਣੇ ਅਤੇ ਇਹ ਬਹੁਤ ਹੀ ਜਲਦੀ ਅਲੋਪ ਹੋ ਰਹੇ ਨੇ ਮੇਰੀ ਸਭ ਤੋਂ ਸੁਰੀ ਮਨਪਸੰਦ ਦਾ ਪੰਛੀ ਕੋਇਲ ਹੈ ਜਦੋਂ ਵੀ ਇਹ ਸੁਰੀਲੀ ਆਵਾਜ਼ ਨਾਲ ਘੂੰ ਘੂੰ ਕਰਦੀ ਹੈ ਮੇਰਾ ਦਿਲ ਵੀ ਘੂੰ ਘੂੰ ਕਰਨ ਲੱਗ ਜਾਂਦਾ ਹੈ ਜਿਸ ਕਰਕੇ ਮੈਂ ਕੋਇਲ ਨੂੰ ਹੀ ਸਭ ਤੋਂ ਸੁਰੀਲੀ ਪੰਛੀ ਮੰਨਦਾ ਹਾਂ